ਬਚਪਨ ਦੀਆਂ ਯਾਦਾਂ ਮੇਰੀਆਂ ਬਹੁਤ ਨੇ ਜੋ ਹਰ ਕਿਸੇ ਦੀਆਂ ਹੁੰਦੀਆਂ ਨੇ ਉਹਦੇ ਵਿੱਚ ਅਸੀਂ ਬਹੁਤ ਆਨੰਦ ਕਰਦੇ ਹਾਂ ਬਚਪਨ ਇੱਕ ਅਜਿਹਾ ਸਮਾਂ ਹੁੰਦਾ ਸਾਡੀ ਜ਼ਿੰਦਗੀ ਦਾ ਜਿਹਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਣੇ ਹਾਂ ਸਾਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਹੁੰਦੀ ਕੁਛ ਨਹੀਂ ਇੱਦਾਂ ਦਾ ਹੁੰਦਾ ਅਤੇ ਮੇਰਾ ਬਚਪਨ ਵੀ ਇੱਦਾਂ ਦਾ ਹੀ ਨਿਕਲਿਆ ਜਿਵੇਂ ਮੇਰੇ ਬਹੁਤ ਹੀ ਮਨਪਸੰਦ ਵਿਅਕਤੀ ਨੇ ਮੇਰੇ ਚਾਚਾ ਜੀ ਉਹਨਾਂ ਨਾਲ ਮੇਰਾ ਬਹੁਤ ਪਿਆਰ ਸੀ ਅਤੇ ਬਚਪਨ 'ਚ ਮੈਂ ਉਹਨਾਂ ਨਾਲ ਬਹੁਤ ਗੇਮਸ ਖੇਡਦੀ ਸੀ ਬਹੁਤ ਹੀ ਗੱਲਾਂ ਮਾਰਦੇ ਸੀ ਉਹਨਾਂ ਦੇ ਬਿਨਾਂ ਖਾਣਾ ਨਹੀਂ ਖਾਂਦੀ ਸੀ ਅਤੇ ਉਨਾਂ ਦੇ ਨਾਲ ਜਿਹੜਾ ਮੇਰਾ ਸਮਾਂ ਬੀਤਿਆ ਸੀ ਉਹ ਸਿਰਫ ਬਚਪਨ 'ਚ ਹੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਦੀ ਨਹੀਂ ਵੇਖਿਆ ਨਾ ਕਦੀ ਮਿਲੀ ਹਾਂ ਅਤੇ ਉਹ ਸਮਾਂ ਮੈਨੂੰ ਵਾਰ ਵਾਰ ਯਾਦ ਆਉਂਦਾ ਕਿ ਹਾਂ ਮੈਂ ਕਿਸੇ ਨਾਲ ਇੱਦਾਂ ਖੇਡਦੀ ਹੁੰਦੀ ਸੀ ਅਤੇ ਉਹਨਾਂ ਨਾਲ ਮੈਂ ਬਹੁਤ ਪਿਆਰ ਕਰਦੀ ਹੁੰਦੀ ਸੀ ਅਤੇ ਗੇਮਸ ਖੇਡਣਾ ਉਹਦੇ ਨਾਲ ਮੇਰੇ ਫਰੈਂਡਸ ਵੀ ਆਉਂਦੇ ਸੀ ਜਿਵੇਂ ਦੋਸਤ ਆਉਣ ਕੇ ਅਤੇ ਉਹਨਾਂ ਨਾਲ ਮਿਲ ਕੇ ਅਸੀਂ ਖੇਡਣਾ ਅਤੇ ਉਹਨਾਂ ਨੇ ਵੀ ਮੈਨੂੰ ਬਹੁਤ ਪਿਆਰ ਦਿੱਤਾ ਬਚਪਨ 'ਚ ਇਹੀ ਇੱਕ ਚੀਜ਼ ਹੈ ਜੋ ਸ਼ਾਇਦ ਮੈਂ ਨਾ ਕਦੀ ਭੁੱਲਣਾ ਚਾਹੁੰਦੀ ਹਾਂ ਅਤੇ ਨਾ ਮੈਂ ਮੈਨੂੰ ਇਹ ਹੈਗਾ ਕਿ ਮੈਂ ਉਸ ਚੀਜ਼ ਨੂੰ ਭੁੱਲਾਂ ਮੈਂ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੁੰਦੀ ਹਾਂ ਆਪਣੇ ਅੰਦਰ ਅਤੇ ਆਹੀ ਮੇਰੀ ਬਚਪਨ ਦੀ ਸਭ ਤੋਂ ਮਨਪਸੰਦ ਚੀਜ਼ ਹੈ ਜੋ ਮੈਂ ਅੱਜ ਤੱਕ ਯਾਦ ਕਰਦੀ ਹਾਂ ਅਤੇ ਮੇਰੇ ਲਈ ਬਹੁਤ ਖਾਸ ਹੈ ਕਿਉਂਕਿ ਉਹ ਵਿਅਕਤੀ ਮੇਰੇ ਲਈ ਬਹੁਤ ਖਾਸ ਹੈ